ਹਾਂਜੀ ਲੋਕਾਂ ਨੇ ਲੋਕਡਾਊਨ ਦੇ ਵਿੱਚ ਮੋਬਾਈਲ ਲੈਪਟੋਪ ਜਾਂ ਕਹਿ ਲਉ ਇੰਟਰਨੈੱਟ ਦੀ ਵਰਤੋਂ ਕਰਨੀ ਜ਼ਿਆਦਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਸ ਕਾਲ ਦੇ ਵਿੱਚ ਅਸੀਂ ਆਪਣੀ ਸਾਡੀ ਜ਼ਿੰਦਗੀਆਂ ਨੇ ਜਿਹੜੀਆਂ ਉਹ ਰੁਕ ਗਈਆਂ ਸੀਗੀਆਂ ਪਰ ਉਹ ਜ਼ਿੰਦਗੀਆਂ ਨੂੰ ਹੌਲੀ ਹੌਲੀ ਚਲਾਉਣ ਦੇ ਵਿੱਚ ਸਭ ਤੋਂ ਯੋਗਦਾਨ ਕਿਹਨੇ ਪਾਇਆ ਸੀਗਾ ਇੰਟਰਨੈੱਟ ਨੇ ਮੋਬਾਈਲ ਨੇ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੱਚਿਆਂ ਨੂੰ ਮੋਬਾਈਲ ਨਹੀਂ ਦੇਣਾ ਹੈਗਾ ਉਹ ਗੇਮਸ ਖੇਡਣਗੇ ਪਰ ਉਦੋਂ ਸਕੂਲਾਂ ਨੇ ਹੀ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਦਿਉ ਤਾਂ ਕਿ ਉਹ ਮੋਬਾਈਲ ਦੀ ਹੈਲਪ ਦੇ ਨਾਲ਼ ਪੜ੍ਹ ਸਕਣ ਸੋ ਜਿਹੜਾ ਉਹ ਮੋਬਾਈਲ ਵਰਤ ਵ ਦੀ ਵਰਤੋਂ ਕਰਨ ਦਾ ਅਤੇ ਲੈਪਟੋਪ ਵਗੈਰਾ ਵਰਤੋਂ ਕਰਨ ਦਾ ਰੁਝਾਨ ਸੀਗਾ ਉਹ ਬੱਚਿਆਂ ਦੇ ਵਿੱਚ ਉਸ ਕਾਲ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਹੁਣ ਜੇ ਆਪਾਂ ਗੱਲ ਕਰੀਏ ਕਰੋਨਾ ਕਾਲ ਦੇ ਵਿੱਚੋਂ ਆਪਾਂ ਨਿਕਲ ਚੁੱਕੇ ਹਾਂ ਪਰ ਅੱਜ ਕੱਲ੍ਹ ਦੇਖਣ ਦੇ ਵਿੱਚ ਕੀ ਆ ਰਿਹਾ ਕਿ ਸਕੂਲਾਂ ਕੋਲਜਾਂ ਦੇ ਵਿੱਚ ਜ ਬੱਚਿਆਂ ਦੀ ਹਾਜ਼ਰੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਘੱਟ ਚੁੱਕੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਚੀਜ਼ਾਂ ਉਹਨਾਂ ਨੂੰ ਸਕੂਲ ਜਾਂ ਫਿਰ ਕੋਲੇਜ ਦੇ ਵਿੱਚ ਪੜ੍ਹਾਈਆਂ ਜਾਣੀਆਂ ਹਨ ਉਹ ਇਜ਼ੀਲੀ ਹੈ ਜਿਹੜਾ ਉਹ ਮੋਬਾਈਲਾਂ ਤੋਂ ਸਿੱਖ ਸਕਦੇ ਹਨ ਤਾਂ ਉਹਨਾਂ ਨੂੰ ਜ਼ਰੂਰੀ ਹੀ ਨਹੀਂ ਲੱਗਦਾ ਕਿ ਉਹ ਰੈਗੂਲਰ ਆਪਣੀਆਂ ਕਲਾਸਾਂ ਦੇ ਵਿੱਚ ਆ ਕੇ ਆਪਣੀਆਂ ਹਾਜ਼ ਹਾਜ਼ਰੀਆਂ ਦੇਣ ਸੋ ਜਿਹੜੀ ਚੀਜ਼ ਆਪਾਂ ਇੱਕ ਬੱਚੇ ਨੂੰ ਇੱਕ ਪੂਰੀ ਕਲਾਸ ਦੇ ਵਿੱਚ ਸਿਖਾਉਣੀ ਹੈ ਔਫ਼ਲਾਈਨ ਮੋਡ ਦੇ ਵਿੱਚ ਸਿਖਾਉਣੀ ਹੈ ਆਪਣੇ ਤਜ਼ਰਬਿਆਂ ਦੇ ਨਾਲ਼ ਸਿਖਾਉਣੀ ਹੈ ਉਹ ਤੋਂ ਜਿਹੜਾ ਉਹ ਬੱਚੇ ਉਹ ਕਾਫ਼ੀ ਜ਼ਿਆਦਾ ਵਿਛੜ ਰਹੇ ਹਨ ਸੋ ਜਿਹੜਾ ਕਰੋਨਾ ਕਾਲ ਦੇ ਵਿੱਚ ਮੋਬਾਈਲ ਲੈਪਟੋਪ ਜਿਹੜਾ ਚਲਾਇਆ ਜਾਂਦਾ ਸੀਗਾ ਉਹਦੀ ਵਰਤੋਂ ਬਹੁਤ ਜ਼ਿਆਦਾ ਹੋਈ ਹੈ ਜਿਹਦੇ ਨਾਲ਼ ਕਾਫ਼ੀ ਜ਼ਿਆਦਾ ਕਹਿ ਲਉ ਇਹਦੀ ਆਪਾਂ ਕਹਿ ਲਉ ਦੁਰਵਰਤੋਂ ਵੀ ਕਹਿ ਸਕਦੇ ਹਾਂ ਆਪਾਂ ਜਿਹੜੀ ਉਹ ਜਿਹੜੀ ਕਾਫ਼ੀ ਜ਼ਿਆਦਾ ਵੱਧ ਗਈ ਹੈ